ਤੁਹਾਨੂੰ ਮੈਂ ਦੱਸਣਾ ਲੱਗਾ ਹਾਂ ਵੀ ਇੱਕ ਖੂਹ ਤੋਂ ਪਾਣੀ ਕਿ ਕਿਵੇਂ ਕੱਢਣਾ ਹੈ ਪਰ ਹੁਣ ਤਾਂ ਅੱਜ ਕੱਲ੍ਹ ਤੁਹਾਨੂੰ ਮੈਂ ਕੀ ਦੱਸਾਂ ਖੂਹ ਇੱਦਾਂ ਦੇ ਪਹਿਲੋਂ ਹੁਣ ਪਹਿਲੋਂ ਦੇ ਬਹੁਤ ਸਾਰੇ ਖੂਹ ਹੀ ਪਰ ਹੁਣ ਤਾਂ ਇੰਨੇ ਸਾਰੇ ਖੂਹ ਤਾਂ ਹੁਣ ਵੇਖਦੇ ਨਹੀਂ ਪਹਿਲੋਂ ਪਿੰਡਾਂ ਵਿੱਚ ਬਹੁਤ ਸਾਰੇ ਖੂਹ ਹੁੰਦੇ ਸੀ ਪਹਿਲਾਂ ਤਾਂ ਪਿੰਡਾਂ ਵਿੱਚ ਖੂਹ ਹੁੰਦੇ ਹੀ ਅਤੇ ਉਹਦੇ ਵਿੱਚੋਂ ਪਾਣੀ ਜਿਵੇਂ ਵੀ ਉੱਤੇ ਪੁਲ਼ੀ ਬਣੀ ਹੁੰਦੀ ਹੀ ਉਹਦੇ ਉੱਤੇ ਰੱਸੀ ਲਪੇਟ ਕੇ ਅਤੇ ਬਾਲਟੀ ਨੂੰ ਖੂਹ ਦੇ ਵਿੱਚ ਪਾ ਦਿੰਦੇ ਸੀ ਅਤੇ ਉੱਦਾਂ ਵਿੱਚ ਦੋ ਦੋ ਪਿੰਡ ਦੇ ਬੰਦੇ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਜਾਣੇ ਰਲ਼ ਕੇ ਉਹ ਰੱਸੀ ਨੂੰ ਖਿੱਚਦੇ ਸੀ ਅਤੇ ਬਾਲਟੀ 'ਚ ਪਾਣੀ ਭਰ ਕੇ ਉੱਤੇ ਉੱਤੇ ਨੂੰ ਖਿੱਚਦੇ ਹੀ ਵੀ ਜਿਹੜੀ ਉਹਨਾਂ ਨੂੰ ਉਹ ਕਰਨ ਲੱਗਾ ਜਿੱਦਾਂ ਕੰਮ ਕਰਨ ਲੱਗਿਆਂ ਬੜੀ ਮੁਸ਼ਕਿਲ ਹੁੰਦੀ ਸੀ ਸਾਰੀ ਦਿਹਾੜੀ ਇੱਦਾਂ ਕਈ ਵਾਰ ਜਦੋਂ ਕਿਸੇ ਔਰਤ ਨੇ ਵੀ ਜਦੋਂ ਇਸਤਰੀ ਨੇ ਪਾਣੀ ਕੱਢਣਾ ਹੁੰਦਾ ਸੀ ਅਤੇ ਉਹਦੇ ਵਾਸਤੇ ਬੜੀ ਮੁਸ਼ਕਿਲ ਆਉਂਦੀ ਫਿਰ ਉਹ ਆਪਣੇ ਘਰ ਵਾਲੇ ਜਾਂ ਕਿਸੇ ਵੀ ਮ ਬੰਦੇ ਨੂੰ ਕਹਿੰਦੀ ਹੀ ਅਤੇ ਉਹਨਾਂ ਨੂੰ ਕੱਢਣ ਦੇ ਵਿੱਚ ਮੁਸ਼ਕਿਲ ਆਉਂਦੀ ਸੀ ਇਸ ਕਰਕੇ ਹੁਣ ਤਾਂ ਟੈਕਨੋਲਜੀ ਨੇ ਬਹੁਤ ਸਾਰੀ ਤਰੱਕੀ ਕੀਤੀ ਅਤੇ ਉਹਦੇ ਕਰਕੇ ਜਿਵੇਂ ਕਿ ਅਸੀਂ ਵੇਖਦੇ ਹਾਂ ਵੀ ਇਲੈਕਟਰੀਕਲ ਮੋਟਰ ਆ ਗਈਆਂ ਵਾ ਜਿਹੜੀਆਂ ਵੀ ਇਲੈਕਟ੍ਰੀਸਿਟੀ 'ਤੇ ਚੱਲ ਪੈਂਦੀਆਂ ਇਲੈਕਟ੍ਰੀਸਿਟੀ ਵਿੱਚ ਹੁਣ ਪਲੱਗ 'ਤੇ ਤਾਰ ਲਾ ਦਈ ਦੀ ਆ ਅਤੇ ਨਾਲੇ ਮੋਟਰ ਘੁੰਮਦੀ ਆ ਅਤੇ ਉਹਨਾਂ ਨਾਲ ਪਾ ਖੂਹ ਦੇ ਵਿੱਚੋਂ ਪਾਣੀ ਨਿਕਲ ਜਾਂਦਾ ਵਾ ਕਈ ਸਾਧਨ ਹੁਣ ਆ ਚੁੱਕੇ ਹਨ ਥੈਂਕ ਯੂ